ਜਿਹੜਾ ਭ੍ਰਿਸ਼ਟਾਚਾਰ ਹੈ ਉਹ ਪੰਜਾਬ 'ਚ ਕੀ ਮਤਲਬ ਹਰੇਕ ਦੇਸ਼ ਦੇ ਵਿੱਚ ਹਰੇਕ ਜਗ੍ਹਾ ਭ੍ਰਿਸ਼ਟਾਚਾਰ ਪਾਇਆ ਜਾਂਦਾ ਹੈ ਪਰ ਆਪਾਂ ਦੇਖਦੇ ਹਾਂ ਕਿ ਉੱਪਰੋਂ ਉੱਪਰੋਂ ਜਦੋਂ ਦੇਖਦੇ ਹਾਂ ਤਾਂ ਸਾਨੂੰ ਸਭ ਕੁਛ ਸਹੀ ਲੱਗਦਾ ਹੈ ਪ੍ਰੰਤੂ ਜਦੋਂ ਅੰਦਰ ਝਾਤੀ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕਈ ਜਗ੍ਹਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਅਤੇ ਕਈ ਖਿਡਾਰੀ ਬਹੁਤ ਮਿਹਨਤ ਕਰਦੇ ਹਨ ਪ੍ਰੰਤੂ ਉਹਨਾਂ ਦੀ ਜਗ੍ਹਾ ਕਈ ਐਵੇਂ ਦੇ ਖਿਡਾਰੀ ਆ ਜਾਂਦੇ ਹਨ ਜਿਹਨਾਂ ਨੂੰ ਖਰੀਦਿਆ ਹੁੰਦਾ ਹੈ ਅਤੇ ਜਿਹੜੇ ਮਿਹਨਤ ਕਰਨ ਵਾਲੇ ਖਿਡਾਰੀ ਹਨ ਉਹਨਾਂ ਨ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਅਤੇ ਇਸੇ ਤਰ੍ਹਾਂ ਖੇਡਾਂ ਦੇ ਵਿੱਚ ਕਈ ਵਾਰ ਐਵੇਂ ਹੁੰਦਾ ਹੈ ਕਿ ਟੀਮ ਦੇ ਵਿੱਚ ਕੋਈ ਖਿਡਾਰੀ ਐਵੇਂ ਦੇ ਹੁੰਦੇ ਹਨ ਜਿਹਨਾਂ ਨੂੰ ਖਰੀਦ ਲਿਆ ਜਾਂਦਾ ਹੈ ਅਤੇ ਉਹ ਆਪਣਾ ਪੂਰਾ ਜੋਰ ਨਹੀਂ ਦਿਖਾ ਪਾਉਂਦੇ ਹੈਗੇ ਇਸ ਲਈ ਉਹਨਾਂ ਦੀ ਟੀਮ ਹਾਰ ਜਾਂਦੀ ਹੈ